ਹੈਲੋ ਆ ਮੈਂ ਵੈਡਿੰਗ ਪਲੇਨਰ ਨਾਲ ਗੱਲ ਕਰ ਰਹੀ ਹਾਂ ਓਕੇ ਓਕੇ ਮੈਂ ਨਾ ਆਪਣੀ ਭੈਣ ਦੀ ਵੈਡਿੰਗ ਪਲੈਨਿੰਗ ਲਈ ਇੱਕ ਮੂਵੀ ਬਣਾਉਣੀ ਆ ਜਿਵੇਂ ਕਹਿੰਦੇ ਨਾ ਪ੍ਰੀ ਵੈਡਿੰਗ ਸ਼ੂਟ ਬਜਟ ਤਾਂ ਕੋਈ ਨਹੀਂ ਮੈਂ ਤੁਹਾਨੂੰ ਦੱਸ ਦਿੰਨੀ ਪੰਜ ਹਜ਼ਾਰ ਜਾਂ ਚਾਰ ਹਜ਼ਾਰ ਤੁਸੀਂ ਆਪਣਾ ਦੱਸ ਦਓ ਫਿਰ ਕਿੰਨਾ ਕਰ ਰਹੇ ਹੋ ਘੱਟ ਤੋਂ ਘੱਟ ਵਿਆਹ ਮੈਂ ਹਿਮਾਚਲ ਹੋ ਰਿਹਾ ਵਾ ਵਿਆਹ ਪਰ ਪ੍ਰੀ ਵੈਡਿੰਗ ਸ਼ੂਟ ਅਸੀਂ ਹਿਮਾਚਲ ਨਹੀਂ ਕਰਵਾਉਣੀ ਨਹੀਂ ਉੱਥੇ ਨਹੀਂ ਕਰਵਾਉਣੀ ਤੁਸੀਂ ਵਧੀਆ ਵਧੀਆ ਪਲੇਸ ਦੱਸ ਦੋਓ ਕਿੱਥੇ ਵਧੀਆ ਲੋਕੇਸ਼ਨ ਰਹੇਗੀ ਲੇਹ ਲੱਦਾਖ ਠੀਕ ਆ ਕਿੰਨੇ ਦਿਨਾਂ ਲਈ ਪ੍ਰੀ ਵੈਡਿੰਗ ਸ਼ੂਟ ਤੁਸੀਂ ਕਰਨਾ ਨਾ ਫਿਰ ਤੁਸੀਂ ਦੱਸ ਦਓ ਕਿ ਕਿੰਨੇ ਦਿਨਾਂ ਤੁਸੀਂ ਕਰ ਸਕਦੇ ਤਿੰਨ ਦਿਨਾਂ ਦਾ ਟਾਈਮ ਹੈ ਹਾਂਜੀ ਮੇਰੇ ਕੋਲ ਨਾ ਇੰਨਾ ਜ਼ਿਆਦਾ ਟਾਈਮ ਹੈ ਨਹੀਂ ਮੀਨੀਮਮ ਤੁਸੀਂ ਪੰਜ ਦਿਨ ਲਗਾ ਲਓ ਪੰਜ ਦਿਨ ਹੋ ਜਾਏਗਾ ਚਾਰ ਦਿਨ ਨਹੀਂ ਤਿੰਨ ਦਿਨ

ਹਾਂਜੀ ਨਹੀਂ ਨਹੀਂ ਲੇਹ ਲੱਦਾਖ ਹੀ ਸਹੀ ਆ ਮੇਰੀ ਭੈਣ ਦੀ ਹੈਗੀ ਨਾ ਵਿਸ਼ ਕਿ ਉਹ ਕਹਿੰਦੀ ਲੇਹ ਲੱਦਾਖ ਹੀ ਕਰਨੀ ਹੈ ਉਹ ਕਹਿੰਦੀ ਵਿਆਹ ਕਿਤੇ ਹੋਰ ਕਰਨਾ ਅਤੇ ਪ੍ਰੀ ਵੈਡਿੰਗ ਸ਼ੂਟ ਕਿਤੇ ਹੋਰ ਕਰਨੀ ਆ ਖਰਚਾ ਪਾਣੀ ਮੈਂ ਕੋਈ ਨਹੀਂ ਤੁਹਾਨੂੰ ਦੱਸ ਦਿੰਦੀ ਹਾਂ ਤੁਸੀਂ ਮੈਨੂੰ ਪਲੇਸਿਸ ਵਗੈਰਾ ਦੱਸ ਦਿਓ ਕਿਵੇ ਕਿਵੇਂ ਕੀ ਕਰਨਾ ਮੈਂ ਪਹਿਲਾਂ ਦੱਸਿਆ ਸੀਗਾ ਪੰਜ ਹਜ਼ਾਰ ਤੁਸੀਂ ਕਿਹਾ ਨਹੀਂ ਇਹ ਤਾਂ ਬਹੁਤ ਘੱਟ ਆ ਫਿਰ ਤੁਸੀਂ ਦੱਸ ਦਓ ਨਾ ਪੱਚੀ ਹਜ਼ਾਰ ਤਾਂ ਭਾਜੀ ਬਹੁਤ ਜ਼ਿਆਦਾ ਤੁਸੀਂ ਵੀਹ ਕਰ ਲਓ ਭਾਜੀ ਇਹ ਤਾਂ ਤੁਸੀਂ ਮਜ਼ਾਕ ਕਰ ਰਹੇ ਹੋ ਤੁਸੀਂ ਸਹੀ ਸਹੀ ਦੱਸੋ ਨਾ ਫਿਰ ਤਾਂ ਹੀ ਆਪਾਂ ਬੁਕਿੰਗ ਕਰਾਂਗੇ ਠੀਕ ਹੈ ਚਲੋ ਆਪਾਂ ਵੱਧ ਤੋਂ ਵੱਧ ਤੇਈ ਕਰ ਲੈਂਦੇ ਨਾ ਤੁਹਾਡੀ ਨਾ ਮੇਰੀ ਆਪਾਂ ਤੇਈ ਮੰਨ ਲੈਂਦੇ ਹਾਂ ਚਲੋ ਠੀਕ ਆ ਆਪਾਂ ਤੁਹਾਡੀ ਮਨ ਲੈਣੇ ਹਾਂ ਸਾਢੇ ਚੌਵੀ ਆਪਾਂ ਬਸ ਅਪ ਨੈਕਸਟ ਵੀਕ ਕਰ ਲੈਂਦੇ ਹਾਂ ਬੁਕਿੰਗ ਠੀਕ ਹੈ ਨਹੀਂ ਨਹੀਂ ਉਹਨਾਂ ਦਾ ਖਰਚਾ ਤਾਂ ਤੁਸੀਂ ਖੁਦ ਚੁੱਕੋਗੇ ਭਾਜੀ ਦੇਖੋ ਤੁਸੀਂ ਥੋੜ੍ਹਾ ਜਿਹਾ ਤਾਂ ਦੇਖੋ ਪਹਿਲਾਂ ਹੀ ਤੁਸੀਂ ਇੰਨੇ ਜ਼ਿਆਦਾ ਬਣਾ ਦਿੱਤੇ ਆ

ਤੁਸੀਂ ਥੋੜ੍ਹਾ ਜਿਹਾ ਘੱਟ ਕਰ ਲਓ ਤੁਸੀਂ ਨਹੀਂ ਤਾਂ ਬੰਦੇ ਦੋ ਲਇਓ ਮੇਰੇ ਨਾਲ ਉਹਨਾਂ ਦਾ ਖਰਚਾ ਅਸੀਂ ਚੁੱਕ ਲੈਂਦੇ ਹਾਂ ਪਲੇਨ ਹੀ ਜਾਣਾ ਹਾਂਜੀ ਹਾਂਜੀ ਨਹੀਂ ਭਾਜੀ ਪਾਸਪੋਰਟ ਨਹੀਂ ਲੱਗਦਾ ਉਹ ਤਾਂ ਫਿਰ ਬਾਹਰ ਜਾਣ ਦਾ ਲੱਗਦਾ ਨਾ ਜਦੋਂ ਆਪਾਂ ਇੱਥੇ ਨੇੜੇ ਤੇੜੇ ਜਾਣਾ ਹੋਵੇ ਫਿਰ ਨਹੀਂ ਲੱਗਦਾ ਉਹ ਕੋਈ ਨਹੀਂ ਅਸੀਂ ਦੇਖ ਲਵਾਂਗੇ ਤੁਸੀਂ ਇਹ ਸਿਰਦਰਦੀ ਨਾ ਲਓ ਬਸ ਤੁਸੀਂ ਪ੍ਰੀ ਵੈਡਿੰਗ ਵਧੀਆ ਕਰਵਾਣੀ ਉਹਦੇ ਗ੍ਰਾਫਿਕਸ ਕੈਮਰਾ ਵਗੈਰਾ ਸਾਰਾ ਕੁਝ ਵਧੀਆ ਰੁਕੇ ਇਕਦਮ ਅਪਰ ਕੁਆਲਿਟੀ ਦਾ ਹੋਣਾ ਚਾਹੀਦਾ ਤੁਸੀਂ ਮੈਨੂੰ ਆਪ ਮੈਨੂੰ ਨਾ ਆਪਣਾ ਜਿਵੇਂ ਡੈਮੋ ਬਣਾਏ ਹੁੰਦੇ ਉਹ ਵੀ ਸੈਂਡ ਕਰ ਦਿਓ ਥੋੜ੍ਹਾ ਆਈਡੀਆ ਲੱਗਜੂ ਠੀਕ ਹੈ ਭਾਜੀ ਤੁਸੀਂ ਮੈਨੂੰ ਆਪਣੇ ਆਫਿਸ ਦਾ ਐਡਰੈਸ ਸੈਂਡ ਕਰ ਦਓ ਹਾਂਜੀ ਲਿਖਵਾਓ ਜੀ ਠੀਕ ਹੈ ਅ ਅੱਗੇ ਅੱਛਾ ਬਸ ਇੰਨਾ ਹੀ ਗਲੀ ਨੰਬਰ ਜਾਂ ਇੱਦਾਂ ਕੁਛ ਨਹੀਂ